ਸਾਡੇ ਭਾਰਤ ਦੇ ਵਿੱਚ ਕਈ ਇਤਿਹਾਸਕ ਘਟਨਾਵਾਂ ਹੋਈਆਂ ਹਨ ਜੋ ਸਾਡੇ ਸਕੂਲ ਵਿੱਚ ਪੜ੍ਹਾਈਆਂ ਜਾਣੀਆਂ ਚਾਹੀਦੀਆਂ ਹਨ ਜਿਸ ਨਾਲ ਸਾਨੂੰ ਸਾਨੂੰ ਉਸ ਚੀਜ਼ ਦਾ ਪਤਾ ਲੱਗੇ ਕਿ ਸਾਡੇ ਦੇਸ਼ ਵਿੱਚ ਲੋਕਾਂ ਨੇ ਆਪਣੇ ਸਾਡੇ ਦੇਸ਼ ਲਈ ਕਿਆ ਕਿਆ ਕੁਛ ਕੀਤਾ ਸੀ ਉਹਨਾਂ ਵਿੱਚ ਇੱਕ ਜਲਿਆਂਵਾਲਾ ਬਾਗ ਦੀ ਕਹਾਣੀ ਬੜੀ ਮਸ਼ਹੂਰ ਹੈ ਜਿਸ ਵਿੱਚ ਇੱਕ ਮੇ ਜਗ੍ਹਾ ਮੇਲਾ ਹੁੰਦਾ ਹੈ ਜਿੱਥੇ ਕਾਫੀ ਮਤਲਬ ਲੋਕ ਇਕੱਠੇ ਹੁੰਦੇ ਹਨ ਅਤੇ ਇੱਕ ਅੰਗਰੇਜ਼ੀ ਮਤਲਬ ਸੈਨਾਨੀ ਜਨਰਲ ਡਾਇਰ ਬਿਨਾਂ ਸੋਚੇ ਸਮਝੇ ਆਪਣੇ ਸਿਪਾਹੀਆਂ ਨੂੰ ਉਹਨਾਂ ਨੂੰ ਗੋਲੀਆਂ ਨਾਲ ਭੁੰਨ ਦੇਣ ਦੀ ਮਤਲਬ ਹੁਕਮ ਦਿੰਦਾ ਹੈ ਅਤੇ ਜਿਸ ਨਾਲ ਉੱਥੇ ਜਿਹੜੇ ਲੋਕ ਇਕੱਠੇ ਹੁੰਦੇ ਹਨ ਉਹ ਉਨ੍ਹਾਂ ਆਪਣੇ ਮਤਲਬ ਜਾਨ ਦੀ ਜਾਨ ਗਵਾ ਕੇ ਬਹਿ ਜਾਂਦੇ ਹਨ ਕਿਉਂਕਿ ਉਹਨਾਂ ਨੂੰ ਜਨਰਲ ਡਾਇਰ ਵੱਲੋਂ ਸਿਪਾਹੀਆਂ ਨੂੰ ਬੋਲਿਆ ਗਿਆ ਹੁੰਦਾ ਕਿ ਇਹਨਾਂ ਨੂੰ ਜਾਨ ਤੋਂ ਮਾਰ ਦਿਉ ਅਤੇ ਉਹ ਜਲਿਆਂਵਾਲਾ ਬਾਗ ਉਦੋਂ ਤੋਂ ਕਾਫੀ ਲਹੂ ਲੁਹਾਣ ਹੋ ਗਿਆ ਸੀ ਅਤੇ ਉਹ ਘਟਨਾ ਸਾਡੇ ਇਤਿਹਾਸ ਵਿੱਚ ਤਾਂ ਪੜ੍ਹਾਈ ਜਾਣੀ ਜ਼ਰੂਰੀ ਹੈ ਅਤੇ ਪੜ੍ਹਾਈ ਵੀ ਜਾਂਦੀ ਹੈ ਇਸ ਤੋਂ ਇਲਾਵਾ ਆਪਣੇ ਸਾਡੇ ਜ ਦੇਸ਼ ਨੇ ਕਾਰਗਿਲ ਯੁੱਧ ਵਿੱਚ ਪਾਕਿਸਤਾਨੀ ਨਾਲ ਲੜ ਕੇ ਆਪਣੇ ਮਤਲਬ ਜਾਨ ਦੀ ਆਹੂਤੀ ਦੇ ਕੇ ਆਪਣੇ ਦੇਸ਼ ਨੂੰ ਪਾਕਿਸਤਾਨੀਆਂ ਤੋਂ ਬਚਾਇਆ ਸੀ ਉਸ ਚੀਜ਼ ਨੂੰ ਵੀ ਸਾਡੇ ਇਤਿਹਾਸ ਵਿੱਚ ਮਤਲਬ ਦਸ ਸ਼ਾਮਲ ਕਰਨਾ ਚਾਹੀਦਾ ਹੈ ਉਸ ਤੋਂ ਇਲਾਵਾ ਸਿੰਧੂ ਘਾਟੀ ਦੀ ਸੱਭਿਅਤਾ ਬਾਰੇ ਵੀ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਸਾਡੇ ਜਿਹੜੇ ਪਿਛਲੇ ਲੋਕ ਸੀ ਉਹ ਕਿਵੇਂ ਆਪਣਾ ਪਹਿਰਾਵਾ ਸੀ ਉਹਨਾਂ ਦਾ ਉਹ ਕਿੱਦਾਂ ਰਹਿੰਦੇ ਸੀ ਕਿੱਦਾਂ ਜਿਉਂਦੇ ਸੀ ਉਹ ਚੀਜ਼ ਵੀ ਸਾਡੇ ਇਤਿਹਾਸ ਵਿੱਚ ਪੜ੍ਹਾਈ ਜਾਣੀ ਜ਼ਰੂਰੀ ਅਤੇ ਮੂਰਤੀਆਂ ਬਾਰੇ ਵੀ ਦੱਸਣਾ ਚਾਹੀਦਾ ਕਿ ਉਹ ਕਿੰਨਾ ਕਿੰਨਾ ਮੂਰਤੀਆਂ ਦੀ ਪੂਜਾ ਕਰਦੇ ਸੀ